ਮੈਂ ਸਕਰੈਚ ਤੋਂ ਬਹੁਤ ਕੁਛ ਬਣਾਉਂਦੀ ਰਹਿੰਦੀ ਹਾਂ ਕਿਉਂਕਿ ਮੈਂ ਹੁਣ ਇੱਕ ਫੱਟੀਆਂ ਫੁੱਟੀਆਂ ਜੋੜ ਕੇ ਆਪਣੇ ਘਰ ਵਿੱਚ ਇੱਕ ਰਸੋਈ ਬਣਾਈ ਹੈ ਬਾਹਰ ਰੱਖਣ ਵਾਸਤੇ ਕਿਉਂਕਿ ਜਿਹੜੀ ਅੰਦਰ ਰਸੋਈ ਹੈ ਉਹ ਸਬਜ਼ੀ ਬਣਾਉਣ ਨਾਲ ਪਰੌਂਠੇ ਬਣਾਉਣ ਨਾਲ ਕਾਲੀ ਹੋ ਜਾਂਦੀ ਹੈ ਅਤੇ ਇਸ ਕਰਕੇ ਮੈਨੂੰ ਬਹੁਤ ਟੈਂਸ਼ਨ ਰਹਿੰਦੀ ਸੀ ਕਿ ਜੇ ਉਹ ਕਾਲੀ ਹੋ ਗਈ ਅਤੇ ਸਫਾਈ ਕਰਨੀ ਬਹੁਤ ਔਖੀ ਹੁੰਦੀ ਹੈ ਅਤੇ ਮੈਂ ਫਿਰ ਇਹ ਰਸੋਈ ਬਾਹਰ ਬਣਾ ਕੇ ਰੱਖੀ ਹੋਈ ਹੈ ਅਤੇ ਇੱਥੇ ਸਬਜ਼ੀ ਵੀ ਬਣਾ ਲਈ ਦੀ ਹੈ ਅਤੇ ਰੋਟੀ ਵੀ ਬਣਾ ਲਈ ਦੀ ਹੈ ਅਤੇ ਉਸ ਦਿਨ ਦਾ ਬਹੁਤ ਸੁੱਖ ਬਣਿਆ ਹੋਇਆ ਕਿ ਅੰਦਰ ਵਾਲੀ ਰਸੋਈ ਕਾਲੀ ਨਹੀਂ ਹੁੰਦੀ ਅਤੇ ਬਹੁਤ ਦਿਲ ਨੂੰ ਖੁਸ਼ੀ ਮਿਲਦੀ ਹੈ ਕਿ ਚਲੋ ਬਹੁਤ ਵਧੀਆ ਕੀਤਾ ਪੁਰਾਣੀ ਚੀਜ਼ ਤੋਂ ਨਵੀਂ ਬਣਾ ਕੇ ਅਤੇ ਵਧੀਆ ਵਧੀਆ ਸਾਡੇ ਕੰਮ ਆਉਂਦੀ ਹੈ ਅਤੇ ਉੱਥੇ ਅਸੀਂ ਬੈਠ ਕੇ ਖਾਣਾ ਬਣਾ ਕੇ ਖਾ ਵੀ ਲੈਂਦੇ ਹਾਂ ਅਤੇ ਮੈਂ ਆਪਣੇ ਮੇਕਅਪ ਵਾਲੇ ਸਮਾਨ ਬਾਹਰ ਰੱਖਣ ਵਾਸਤੇ ਵੀ ਬਹੁਤ ਸੋਹਣੇ ਡੱਬੇ ਬਣਾ ਕੇ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਅੱਡੋ ਅੱਡ ਪਾਈਆਂ ਹੁੰਦੀਆਂ ਹਨ ਕਿਉਂਕਿ ਇੱਕ ਵੀ ਚੀਜ਼ ਇੱਧਰ ਉੱਧਰ ਖਿਲਰੀ ਨਹੀਂ ਮਿਲਦੀ ਕਿਉਂਕਿ ਮੈਨੂੰ ਸਫਾਈ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਸਫਾਈ ਬਹੁਤ ਰੱਖਦੀ ਹਾਂ ਇਸ ਕਰਕੇ ਮੈਨੂੰ ਇਹੀ ਹੁੰਦਾ ਚਾਰ ਚੁਫੇਰੇ ਸਫਾਈ ਸਫਾਈ ਹੋਣੀ ਚਾਹੀਦੀ ਹੈ ਅਤੇ ਸਭ ਕੁਝ ਸੋਹਣਾ ਸੋਹਣਾ ਦਿਸਦਾ ਰਵੇ